ਵੈਸੇ ਤਾਂ ਮੈਂ ਬਹੁਤ ਤਰੀਕੇ ਦੇ ਪਕਵਾਨ ਬਣਾਏ ਹਨ ਜਿਵੇਂ ਕਿ ਡੋਸਾ ਹੋ ਗਿਆ ਅੱਪੇ ਹੋ ਗਏ ਬੜਾ ਪਾਓ ਹੋ ਗਿਆ ਦਾਲ ਸਾਂਬਰ ਇਸ ਤਰੀਕੇ ਦੀ ਚੀਜ਼ਾਂ ਹੈ ਜਿਹੜੀ ਮੈਂ ਦਿਨ ਪ੍ਰਤੀ ਦਿਨ ਦੀ ਸਮੇਂ 'ਚ ਬਣਾਉਂਦਾ ਰਹਿੰਦਾ ਹਾਂ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਦਾਲ ਅਤੇ ਸਾਂਬਰ ਮੈਨੂੰ ਸਭ ਤੋਂ ਔਖੇ ਲੱਗਦੇ ਹਨ ਕਿਉਂਕਿ ਉਹਨਾਂ 'ਤੇ ਬਹੁਤ ਸਾਰੀ ਸਬਜ਼ੀਆਂ ਜਿਹੜੀ ਹੈ ਉਹ ਕੱਟਣੀ ਪੈਂਦੀਆਂ ਹਨ ਅਤੇ ਸਬਜ਼ੀਆਂ ਨੂੰ ਮਿਕਸ ਕਰਨਾ ਉਨ੍ਹਾਂ ਨੂੰ ਸਾਂਬਰ ਦੇ ਅੰਦਰ ਪਕਾਉਣਾ ਉਹਨੂੰ ਕਾਫ਼ੀ ਦੇਰ ਤੱਕ ਮਤਲਬ ਹੌਲੀ ਹੌਲੀ ਆਚ 'ਚ ਚਲਾਉਣਾ ਪੈਂਦਾ ਹੈ ਤਾਂ ਇਸ ਕਰਕੇ ਮੈਨੂੰ ਜਿਹੜਾ ਹੈ ਉਹ ਥੇੋੜ੍ਹਾ ਔਖਾ ਲੱਗਦਾ ਹੈ ਅਤੇ ਜੇ ਗੱਲ ਕਰੀਏ ਆਪਾਂ ਅੱਪੇ ਦੀ ਤਾਂ ਮੈਨੂੰ ਉਹ ਥੋੜ੍ਹਾ ਜਿਹਾ ਸੌਖਾ ਲੱਗਦਾ ਕਿਉਂਕਿ ਉਹਦੇ ਅੰਦਰ ਸੂਜੀ ਦਾ ਇਸਤੇਮਾਲ ਕੀਤਾ ਜਾਂਦਾ ਅਤੇ ਜੇ ਆਪਾਂ ਸੂਜੀ ਦਾ ਇਸਤੇਮਾਲ ਕਰਦੇ ਹਨ ਬਾਕੀ ਸਬਜ਼ੀਆਂ ਮਿਕਸ ਕਰਕੇ ਜਦ ਉਹਨੂੰ ਬਣਾਉਂਦੇ ਹਨ ਤਾਂ ਇੱਕ ਤਾਂ ਉਹ ਬਹੁਤ ਹੀ ਜਲਦੀ ਤਰੀਕੇ ਨਾਲ ਬਣ ਜਾਂਦੀ ਹੈ ਅਤੇ ਉਹ ਹੈਂਲਦੀ ਵੀ ਹੈ ਅਤੇ ਉਹਨੂੰ ਪਚਾਉਣਾ ਵੀ ਬਹੁਤ ਸੌਖਾ ਹੁੰਦਾ ਹੈ ਅਤੇ ਜੇ ਆਪਾਂ ਡੋਸਾ ਦੀ ਗੱਲ ਕਰੀਏ ਤਾਂ ਉਹ ਮਤਲਬ ਠੀਕ ਠਾਕ ਜਿਹਾ ਹੁੰਦਾ ਹੈ ਡੋਸਾ ਵੀ ਜਲਦੀ ਬਣ ਜਾਂਦਾ ਹੈ ਅਤੇ ਉਹ ਵੀ ਸਾਡੇ ਸਿਹਤ ਲਈ ਬਹੁਤ ਹੀ ਹੈਲਦੀ ਹੁੰਦਾ ਹੈ